ਮੈਂ ਕਿਸੇ ਲਈ ਤੋਹਫ਼ੇ ਦੇ ਵਜੋਂ ਕੋਈ ਗਦ ਕਾਵਿ ਨਹੀਂ ਲਿਖਿਆ ਹੈ ਪਰ ਮੈਨੂੰ ਸ਼ੌਕ ਹੈ ਕਿ ਮੈਂ ਤੋਹਫ਼ੇ ਦੇ ਵਜੋਂ ਉਹਨਾਂ ਦੀ ਸ਼ਬਦਾਂ ਰਾਹੀਂ ਹੱਲਾ ਸ਼ੇਰੀ ਦੇਵਾਂ ਤਾਂਕਿ ਉਹ ਮੇਰੀ ਹੱਲਾ ਸ਼ੇਰੀ ਦੇਖਦੇ ਹੋਏ ਆਪਣਾ ਲਗਾਅ ਹੋਰ ਉੱਚਾ ਰੱਖਣ ਇਹ ਮੈਨੂੰ ਬਹੁਤ ਹੀ ਪਸੰਦ ਹੈ